ਮੇਰੇ ਇਲਾਕੇ ਦੇ ਬਹੁਤ ਸਾਰੇ ਪ੍ਰਾਈਵੇਟ ਬੈਂਕ ਹਨ ਜਿਵੇਂ ਐਚ ਡੀ ਐਫ ਸੀ ਬੈਂਕ ਆਈ ਸੀ ਆਈ ਸੀ ਆਈ ਬੈਂਕ ਐਕਸਿਸ ਬੈਂਕ ਇੰਡੀਆ ਲਿਮਿਟਿਡ ਕੋਟਕ ਮਹਿੰਦਰਾ ਬੈਂਕ ਇੱਥੋਂ ਕਰਜ਼ੇ ਅਤੇ ਬੀਮੇ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ ਅਤੇ ਸਰਕਾਰੀ ਬੈਂਕਾਂ ਵਿੱਚ ਵੀ ਇਹ ਕੰਮ ਹੁੰਦੇ ਹਨ ਅਤੇ ਮੇਰੇ ਖ਼ਿਆਲ ਵਿੱਚ ਜੋ ਸਰਕਾਰੀ ਬੈਂਕ ਹਨ ਉਹ ਜ਼ਿਆਦਾ ਸੁਰੱਖਿਅਤ ਹਨ ਕਿਉਂਕਿ ਉੱਥੇ ਵਿਆਜ਼ ਦੀ ਦਰ ਘੱਟ ਹੁੰਦੀ ਹੈ ਅਤੇ ਬਹੁਤ ਘੱਟ ਅਮਾਊਂਟ ਜੋ ਹੈ ਉਹ ਮੋੜਨੀ ਪੈਂਦੀ ਹੈ ਅਤੇ ਇਹ ਸੁਰੱਖਿਅਤ ਵੀ ਹਨ